ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਘਰ ਵਿੱਚ ਜਿਹੜੀ ਇੱਕ ਰਸੋਈ ਹੁੰਦੀ ਆ ਰਸੋਈ ਦੇ ਵਿੱਚ ਬਹੁਤ ਸਾਰੇ ਬਰਤਨ ਪਏ ਹੁੰਦੇ ਜਿਹਦੇ ਕਿ ਵੱਖ ਵੱਖ ਉਹਨਾਂ ਦੇ ਵੱਖ ਵੱਖ ਤਰੀਕੇ ਨਾਲ ਉਹਨਾਂ ਨੂੰ ਵਰਤਿਆ ਜਾਂਦਾ ਜੇ ਮੈਂ ਆਪਣੇ ਘਰ ਦੀ ਰਸੋਈ ਦੀ ਗੱਲ ਕਰਾਂ ਤਾਂ ਸਾਡੇ ਘਰ ਦੀ ਰਸੋਈ ਦੇ ਵਿੱਚ ਵੀ ਬਹੁਤ ਸਾਰੇ ਬਰਤਨ ਨੇ ਜੇ ਸਾਰੇ ਬਰਤਨਾਂ ਦੀ ਗੱਲ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਸਮਾਂ ਜ਼ਿਆਦਾ ਹੋ ਜਾਵੇਗਾ ਫੇਰ ਵੀ ਮੈਂ ਕੁਝ ਮੁੱਖ ਮੁੱਖ ਬਰਤ ਬਰਤਨ ਨੇ ਜਿਹੜੇ ਉਹਨਾਂ ਬਾਰੇ ਦੱਸ ਸਕਦਾ ਜਿਵੇਂ ਸਾਡੇ ਰਸੋਈ ਦੇ ਵਿੱਚ ਪਤੀਲੇ ਨੇ ਕੁੱਕਰ ਆ ਥਾਲੀਆਂ ਨੇ ਚਮਚੇ ਨੇ ਕੌਲੀਆਂ ਨੇ ਗਿਲਾਸ ਨੇ ਕੱਪ ਨੇ ਔਰ ਇਹਨਾਂ ਸਾਰਿਆਂ ਬਰਤਨਾਂ ਦੀ ਆਪਣੀ ਆਪਣੀ ਰਸੋਈ ਵਿੱਚ ਵੱਖਰੀ ਵੱਖਰੀ ਭੂ ਭੂਮਿਕਾ ਜਿਵੇਂ ਅਸੀਂ ਜਿਹੜਾ ਕੁੱਕਰ ਆ ਉਹ 'ਚ ਚੋਲ ਜਾਂ ਦਾਲ ਬਣਾ ਸਕਦੇ ਹਾਂ ਪਤੀਲੇ ਵਿੱਚ ਅਸੀਂ ਚਾਹ ਬਣਾ ਸਕਦੇ ਹਾਂ ਦੁੱਧ ਗਰਮ ਕਰ ਸਕਦੇ ਹਾਂ ਫਰਾਈਵੀਲਰ ਵਿੱਚ ਆ ਜਿਹੜੀ ਥਾਲੀ ਆ ਥਾਲੀ ਵਿੱਚ ਅਸੀਂ ਰੋਟੀ ਪਰੋਸ ਸਕਦੇ ਹਾਂ ਕੌਲੀ ਵਿੱਚ ਅਸੀਂ ਦਹੀਂ ਜਾਂ ਸਬਜ਼ੀ ਕੋਈ ਖਾਣੀ ਆ ਉਹ ਖਾ ਸਕਦੇ ਹਾਂ ਚਮਚੇ ਨਾਲ ਅਸੀਂ ਸਬਜ਼ੀ ਖਾ ਸਕਦੇ ਹਾਂ ਔਰ ਜੋ ਗਿਲਾਸ ਹੈ ਉਹਦੀ ਮਦਦ ਨਾਲ ਅਸੀਂ ਪਾਣੀ ਪੀਣਾ ਜਾਂ ਦੁੱਧ ਪੀਣਾ ਉਹ ਪੀ ਸਕਦੇ ਹਾਂ ਔਰ ਜਿਹੜੇ ਸਾਡੇ ਰਸੋਈ ਦੇ ਵਿੱਚ ਬਰਤਨਾਂ ਵਿੱਚ ਕੱਪ ਆਉਂਦੇ ਨੇ ਕੱਪ ਦੇ ਵਿੱਚ ਅਸੀਂ ਚਾਹ ਪੀ ਸਕਦੇ ਹਾਂ ਔਰ ਇਸ ਤਰ੍ਹਾਂ ਬਹੁਤ ਸਾਰੇ ਬਰਤਨ ਹੁੰਦੇ ਨੇ ਜਿਵੇਂ ਚਮਚੇ ਕੜਛੀਆਂ ਕੜਛੀ ਜਿਹੜੀ ਆ ਪਲਟਾ ਇਹਨਾਂ ਸਾਰਿਆਂ ਦੀ ਮਦਦ ਨਾਲ ਅਸੀਂ ਸਬਜ਼ੀ ਬਣਾਉਂਦੇ ਹਾਂ ਸਬਜ਼ੀ ਨੂੰ ਹਿਲਾਉਂਦੇ ਹਾਂ ਕੜਛੀ ਦੇ ਨਾਲ ਔਰ ਇਹ ਸਾਰੇ ਜਿਹੜੇ ਬਰਤਨ ਨੇ ਮੈਨੂੰ ਲੱਗਦਾ ਇਹ ਰਸੋਈ ਦੇ ਵਿੱਚ ਹੋਣੇ ਬੜੇ ਜ਼ਰੂਰੀ ਨੇ ਔਰ ਇਹਨਾਂ ਸਾਰਿਆਂ ਦੀ ਇੱਕ ਆਪਣੀ ਆਪਣੀ ਵੱਖਰੀ ਭੂਮਿਕਾ ਵਾ ਇੱਕ ਵੀ ਬਰਤਨ ਜੇ ਵਿੱਚੋਂ ਨਿਕਾਲ ਦਿੱਤਾ ਜਾਵੇ ਤਾਂ ਮੈਨੂੰ ਲੱਗਦਾ ਕਿ ਰਸੋਈ ਜਿਹੜੀ ਆ ਅਧੂਰੀ ਰਹਿ ਜਾਂਦੀ ਹੈ ਕਿਉਂਕਿ ਜਿਹੜੀ ਰਸੋਈ ਆ ਉਹ ਪੂਰੀ ਰਸੋਈ ਉਦੋਂ ਹੀ ਬਣਦੀ ਹੈ ਜਦੋਂ ਉਹਦੇ ਵਿੱਚ ਸਾਰੇ ਹੀ ਬਰਤਨ ਮੌਜੂਦ ਹੋਣ ਔਰ ਉਹਨਾਂ ਸਾਰੇ ਹੀ ਬਰਤਨਾਂ ਦਾ ਜਿਹੜਾ ਸਹੀ ਢੰਗ ਨਾਲ ਸੁਚੱਜੇ ਤਰੀਕੇ ਨਾਲ ਉਹਨਾਂ ਦੀ ਜਿਹੜੀ ਆ ਵਰਤੋਂ ਕੀਤੀ ਜਾਂਦੀ ਹੈ